ਹੈਲੋ ਹਾਂਜੀ ਵੀਰੇ ਹਾਂਜੀ ਕੌਣ ਬੋਲ ਰਹੇ ਕੌਣ ਬੋਲ ਰਿਹਾ ਅੱਛਾ ਅੱਛਾ ਓਕੇ ਜੀ ਤੇ ਤੁਸੀਂ ਮਤਲਬ ਰਿਹਾਇਸ਼ ਕਿੱਧਰ ਦੀ ਆ ਤੁਹਾਡੀ ਅੱਛਾ ਅੱਛਾ ਅਤੇ ਤੁਹਾਨੂੰ ਉਰੇ ਪੀ ਜੀ ਚਾਹੀਦੇ ਠੀਕ ਹੈ ਮਤਲਬ ਪੀ ਜੀ ਨੇੜੇ ਤੇੜੇ ਚੱਲ ਜੂਗਾ ਜਾਂ ਫਿਰ ਥੋੜ੍ਹਾ ਜਿਹਾ ਦੂਰ ਹੋ ਜਾਵੇ ਨੇੜੇ ਤੇੜੇ ਦਾ ਵੀਰੇ ਇੱਦਾਂ ਹੈਗਾ ਯੂਨੀਵਰਸਿਟੀ ਦੇ ਗੇਟ ਦੇ ਬਿਲਕੁਲ ਸਾਹਮਣੇ ਨਾ ਔਫੀਸਰ ਕਲੋਨੀ ਹੈ ਉੱਥੇ ਬਹੁਤ ਸਾਰੇ ਪੀਜੀਸ ਨੇ ਅਤੇ ਤੁਹਾਨੂੰ ਪੀ ਜੀ ਇੰਡੀਪੈਂਡੈਂਟ ਚਾਹੀਦਾ ਜਾਂ ਫਿਰ ਕਿਵੇਂ ਇੰਡੀਪੈਂਡੈਂਟ ਮਤਲਬ ਜਿਹਦੇ ਵਿੱਚ ਬੋਇਸ ਗਰਲਸ ਦੋਵੇਂ ਰਹਿ ਸਕਦੇ ਆ ਜਾਂ ਫਿਰ ਇੱਕ ਡਿਪੈਡੈਂਟ ਹੁੰਦਾ ਜਿਵੇਂ ਬੋਇਸ ਦਾ ਅਲੱਗ ਹੁੰਦਾ ਗਰਲਸ ਦਾ ਅਲੱਗ ਹੁੰਦਾ ਤੁਹਾਨੂੰ ਕਿਹੋ ਜਿਹਾ ਚਾਹੀਦਾ ਪ੍ਰਾਈਜ਼ ਵੀਰੇ ਹਰੇਕ ਪੀ ਜੀ ਦੇ ਨਾ ਸਾਢੇ ਚਾਰ ਤੋਂ ਪੰਜ ਹਜ਼ਾਰ ਦੇ ਵਿੱਚ ਵਿੱਚ ਪੈਂਦੇ ਆ ਪਰ ਮੰਥ ਅਤੇ ਉਰੇ ਤੁਹਾਨੂੰ ਇੰਡੀਪੈਡੈਂਟ ਪੀਜੀਸ ਬਹੁਤ ਘ ਰੇਅਰ ਹੀ ਦੇਖਣ ਨੂੰ ਮਿਲਣਗੇ ਸਾਰੇ ਸਪੈਸੀਫਿਕ ਪੀਜੀਸ ਨੇ ਬੋਇਜ਼ ਦੇ ਸੈਪਰੇਟ ਅਤੇ ਗਰਲਸ ਦੇ ਸੈਪਰੇਟ ਪਲੱਸ ਇਹ ਜਿਹੜਾ ਰੈਂਟ ਹੈ ਇਸਦੇ ਵਿੱਚ ਤੁਹਾਨੂੰ ਵਧੀਆ ਰੂਮ ਮਿਲੂਗਾ ਅਟੈਚ ਵਾਸ਼ਰੂਮ ਮਿਲੂਗਾ ਨਾਲ ਏ ਸੀ ਵੀ ਲੱਗੇ ਹੁੰਦੇ ਨੇ ਅਤੇ ਤੁਹਾਡਾ ਬਿਜਲੀ ਦਾ ਮੀਟਰ ਅਲੱਗ ਹੋਊਗਾ ਜਿੰਨੀ ਤੁਸੀਂ ਬਿਜਲੀ ਫੂਕੋਗੇ ਉਸਦਾ ਰੈਂਟ ਤੁਸੀਂ ਅਲੱਗ ਤੋਂ ਪੇ ਕਰ ਸਕਦੇ ਹੋ ਅਤੇ ਨਾਲ ਕੁਝ ਪੀਜੀਸ ਦੇ ਵਿੱਚ ਵਾਈਫਾਈ ਹੁੰਦਾ ਕੁਝ ਦੇ ਵਿੱਚ ਨਹੀਂ ਹੁੰਦਾ ਹਾਂਜੀ ਮਤਲਬ ਸ਼ੇਅਰਿੰਗ ਬੇਸਿਸ 'ਤੇ ਨਹੀਂ ਲੈਣਾ ਅਤੇ ਤੁਸੀਂ ਐ ਕਰਿਓ ਉੱਧਰ ਨਾ ਇਲੀਟ ਹੋਸਪਿਟਲ ਦੇ ਨਾ ਸਾਹਮਣੇ ਇੱਕ ਦੋ ਪੀਜੀਜ ਨੇ ਮੇਰੀ ਜਾਣ ਪਹਿਚਾਣ ਵੀ ਹੈਗੀ ਉੱਥੇ ਤੁਸੀਂ ਕੱਲ੍ਹ ਨੂੰ ਮੈਨੂੰ ਕਾਲ ਕਰ ਲਿਓ ਆਪਾਂ ਚੱਲਾਂਗੇ ਥੋੜ੍ਹਾ ਬਹੁਤ ਡਿਸਕਾਊਂਟ ਵਗੈਰਾ ਵੀ ਹੋ ਜਾਊਗਾ ਰ ਰੈਂਟ ਸਾਢੇ ਚਾਰ ਤੋਂ ਪੰਜ ਹਜ਼ਾਰ ਦੇ ਵਿੱਚ ਵਿੱਚ ਹੁੰਦਾ ਪਰ ਮੰਨਥ ਹਾਂਜੀ ਉਹ ਆਪਾਂ ਕੱਲ੍ਹ ਨੂੰ ਚੱਲ ਪਾਂਗੇ ਤੁਸੀਂ ਮੈਨੂੰ ਕਾਲ ਕਰ ਲਿਓ ਕੱਲ੍ਹ ਨੂੰ